ਮੈਂ ਆਪਣੇ ਪਰਿਵਾਰ ਨਾਲ਼ ਘੁੰਮਣਾ ਜ਼ਿਆਦਾ ਪਸੰਦ ਕਰਦੀ ਹਾਂ ਅਕਸਰ ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਾਰਾ ਪਰਿਵਾਰ ਇਕੱਠਾ ਹੋ ਕੇ ਘੁੰਮਣ ਜਾਂਦਾ ਹੈ ਅਤੇ ਅਸੀਂ ਪੂਰਾ ਅਨੰਦ ਮਾਣਦੇ ਹਾਂ ਪਰਿਵਾਰ ਨਾਲ ਘੁੰਮਣਾ ਇੱਕ ਤਾਂ ਮੈਨੂੰ ਸੁਰੱਖਿਅਤ ਲੱਗਦਾ ਹੈ ਅਤੇ ਖਰਚੇ ਦੀ ਵੀ ਕੋਈ ਟੈਨਸ਼ਨ ਨਹੀਂ ਹੁੰਦੀ ਜੋ ਅਨੰਦ ਪੂਰੇ ਪਰਿਵਾਰ ਨਾਲ਼ ਘੁੰਮ ਕੇ ਆਉਂਦਾ ਹੈ ਉਹ ਮੈਨੂੰ ਕਿਸੇ ਹੋਰ ਦੇ ਨਾਲ਼ ਜਾ ਕੇ ਨਹੀਂ ਆਉਂਦਾ